ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਅੱਛਾ ਕਿੱਥੇ ਜੀ ਚਲੋ ਫਿਰ ਤਾਂ ਤੁਸੀਂ ਜੇ ਚੱਬੇ ਵਾਲੇ ਦੇ ਕੋਲ ਆਉਂਗੇ ਤਾਂ ਤੁਸੀਂ ਦੇਖੋਗੇ ਡੀ ਐਸ ਢਾਬਾ ਹੋਣਾ ਜਦੋਂ ਆਉਂਦੇ ਨਾ ਆਪ ਤਾਂ ਹਾਂਜੀ ਔਨ ਰੋਡ ਹੀ ਮਿਲ ਜਾਣਾ ਤੁਹਾਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਸਾਈਡ ਆਉਂਦੇ ਹੋਵੋਗੇ ਤੁਹਾਨੂੰ ਰ ਆਨ ਰੋਡ ਹੀ ਮਿਲ ਜਾਣਾ ਡੀ ਐਸ ਢਾਬਾ ਬਹੁਤ ਵਧੀਆ ਉਹ ਕਾਫੀ ਮਸ਼ਹੂਰ ਹੈਗਾ ਅਤੇ ਪਰ ਹੁਣ ਕਾਫੀ ਹਨੇਰਾ ਹੋ ਗਿਆ ਇਸ ਟਾਈਮ ਤਾਂ ਹਾਂਜੀ

ਸਨੈਕਸ ਤਾਂ ਹੁੰਦੇ ਆ ਪਰ ਹੁਣ ਇਸ ਟਾਈਮ ਤਾਂ ਤੁਹਾਨੂੰ ਡਿਨਰ ਹੀ ਹੋਣਾ ਇਸ ਟਾਈਮ ਸਨੈਕਸ ਵਗੈਰਾ ਦਾ ਟਾਈਮ ਤਾਂ ਉਹ ਈਵਨਿੰਗ ਟਾਈਮ ਮਿਲ ਜਾਂਦਾ ਵੇ ਜ਼ਿਆਦਾਤਰ ਛੇ ਕੁ ਵਜੇ ਤੱਕ ਉਹ ਵਧੀਆ ਵਧੀਆ ਬਿਲਕੁਲ ਹਰੇਕ ਚੀਜ਼ ਹੈਗੀ ਡਿਨਰ ਜੋ ਵੀ ਤੁਸੀਂ ਘਰ ਰੋਟੀ ਜਿੱਦਾਂ ਦੀ ਖਾਂਦੇ ਹੋ ਉਸ ਤਰ੍ਹਾਂ ਦੀ ਬਣਦੀ ਆ ਨਾਲ ਉੱਥੇ ਰੋਟੀ ਬਿਲਕੁਲ ਨਾਲ ਤੰਦੂਰੀ ਰੋਟੀ ਨਹੀਂ ਦੂਜੀ ਮਿਲ ਜਾਂਦੀ ਹੈਗੀ ਤਵੇ ਵਾਲੀ ਹਾਂ ਇਹ ਫਾਇਦਾ ਹੈਗਾ ਸਾਗ ਤਾਂ ਹੈ ਤੁਹਾਨੂੰ ਵਧੀਆ ਉੱਥੇ ਸਾਗ ਬਿਲਕੁਲ ਵਧੀਆ ਹੈਗਾ ਨਾਲ ਵਧੀਆ ਬਣਾਉਂਦੇ ਨੇ ਅਤੇ ਮੈਂ ਗਿਆ ਕਾਫੀ ਵਾਰ ਅਤੇ ਮੈਂ ਤਾਂ ਹੀ ਦੱਸ ਹਾਂ ਜੀ ਆਪਾਂ ਤਕਰੀਬਨ ਜਾਂਦੇ ਰਹਿੰਦੇ ਹਾਂ ਰੇਟ ਜੈਨੁਅਨ ਨੇ ਜਿੱਦਾਂ ਬਾਕੀ ਪ੍ਰਾਈਜਿਜ ਹੈਗੇ ਨੇ ਬਾਕੀਆਂ ਨਾਲੋਂ ਹਾਂ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਔਨਲਾਈਨ ਚੈੱਕ ਕਰ ਲਿਓ ਤਾਂ ਕੋਈ ਨਾ ਕੋਈ ਰੇਟਿੰਗ ਹੋਣੀ ਇਹਦੀ ਬੈਸਟ ਡਿਸ਼ਿਜ ਹੈਗੀ ਹੈ ਉਹਨਾਂ ਨੇ ਆਪਣੇ ਪੇਜ 'ਤੇ ਪਾਇਆ ਕੁਛ ਨਾ ਕੁਛ ਪਾਉਂਦੇ ਰਹਿੰਦੇ ਆ ਉਹਨਾਂ ਦਾ ਪੇਜ ਵੀ ਹੈਗਾ ਫੇਸਬੁੱਕ 'ਤੇ ਫੋਲੋ ਕਰਦੇ ਉੱਥੇ ਦੇਖ ਲਉ ਕੋੋਈ ਜਿੰਨੀ ਕੁ ਦੇਰ ਨੂੰ ਤੁਸੀਂ ਪਹੁੰਚਣਾ ਉਦੋਂ ਤੱਕ ਚੈੱਕ ਕਰ ਸਕਦੇ ਹਾਂ ਹਾਂਜੀ ਹਾਂਜੀ ਚੈੱਕ ਕਰ ਲਉ ਵੈਸੇ ਪਰ ਹੈਗਾ ਵਧੀਆ ਹੀ ਆ ਮੈਂ ਉਹੀ ਸੁਜੈਸਟ ਕਰੂੰਗਾ ਵੀ ਉੱਥੇ ਵਧੀਆ ਉਹ ਅੰਕਲ ਵੀ ਖੁੱਲ੍ਹਾ ਵਾ ਨਹੀਂ ਹੋਣਾ ਇਸ ਟਾਈਮ ਹੁਸ਼ਿਆਰਪੁਰ ਦੇ ਅਤੇ ਸ਼ਹਿਰ 'ਚ ਆਉਣਾ ਪੈਣਾ ਤੁਹਾਨੂੰ ਹਾਂ ਉੱਥੇ ਮੋਸਟਲੀ ਜਿਹੜੇ ਚੰਡੀਗੜ੍ਹ ਤੋਂ ਬਸਿਜ ਵੀ ਆਉਂਦੀਆਂ ਜਾਂ ਹੋਰ ਵੀ ਟੂਰਿਸਟ ਆਉਂਦੇ ਆ ਅੱਗੇ ਜੰਮੂ ਜਾਂਦੇ ਸਾਰੇ ਉੱਥੇ ਰੁਕ ਕੇ ਜਾਂਦੇ ਨੇ ਉਹ ਨੀਅਰਬਾਏ ਪੈ ਜਾਂਦਾ ਸਾਰਾ ਵਧੀਆ ਅੱਗੇ ਔਨ ਰੋਡ ਕਰਕੇ ਅਤੇ ਹੈਗਾ ਵੀ ਕਾਫੀ ਖੁੱਲ੍ਹਾ ਅਤੇ ਚੰਡੀਗੜ੍ਹੋਂ ਆਉਂਦਿਆਂ ਨੂੰ ਤੁਹਾਨੂੰ ਲੈਫਟ ਸਾਈਡ ਪੈਣਾ ਬਿਲਕੁਲ ਨਹੀਂ ਹੋਊਗਾ ਹੋਊਗਾ ਹੋਊਗਾ ਮਿਲੇਗਾ ਇੱਥੇ ਤਕਰੀਬਨ ਕਰੀਬ ਜਿਹੜੇ ਲੋਕ ਸ਼ਹਿਰ ਦੇ ਨੇ ਉਹ ਡਿਨਰ ਕਰਨ ਲਈ ਜਾਂਦੇ ਨੇ ਉੱਥੇ ਕਾਫੀ ਦੇਰ ਤੋਂ ਅਤੇ ਹੋਰ ਵੀ ਹਾਂਜੀ ਹਾਂਜੀ ਜਿੱਦਾਂ ਲੇਟ ਨਾਈਟ ਬਸਿਸ ਆਉਂਦੀਆਂ ਉਹ ਵੀ ਉੱਥੇ ਰੁਕ ਜਾਂਦੀਆਂ ਤਾਂ ਡਿਨਰ ਹੁੰਦਾ ਹਾਂਜੀ ਬਸਿਸ ਜ਼ਰੂਰ ਜ਼ਰੂਰ ਠੀਕ ਆ ਇੰਜੋਏ ਯੂਅਰ ਫੂਡ ਓਕੇ ਬਾਏ